ਹਾਂ ਅਜਿਹੇ ਬਹੁਤ ਸਾਰੇ ਵਿਸ਼ੇ ਹਨ ਜਿਸ ਉੱਪਰ ਮੈਂ ਲਿਖਣਾ ਚਾਹੁੰਦਾ ਹਾਂ ਪਰ ਕਈ ਵਾਰ ਝਿਜਕ ਜਾਂਦਾ ਹਾਂ ਸਭ ਤੋਂ ਵੱਡਾ ਵਿਸ਼ਾ ਏ ਇਸ ਵਕਤ ਭਾਰਤ ਦੇ ਵਿੱਚ ਭ੍ਰਿਸ਼ਟਾਚਾਰ ਜੋ ਕਿ ਬਹੁਤ ਵੱਡੇ ਪੱਧਰ 'ਤੇ ਵੱਧ ਰਿਹਾ ਹੈ ਈਵਨ ਕਿ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਭ੍ਰਿਸ਼ਟਾਚਾਰ ਇੰਨਾਂ ਜ਼ਿਆਦਾ ਵੱਧ ਚੁੱਕਿਆ ਹੈ ਕਿ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਪੈ ਰਿਹਾ ਬੱਚਿਆਂ ਨੂੰ ਦਾਖਲੇ ਭਰਿਸ਼ਟਾ ਬੱਚਿਆਂ ਦੇ ਦਾਖਲੇ ਲੈਣ ਵਿੱਚ ਵੀ ਭ੍ਰਿਸ਼ਟਾਚਾਰ ਹੈ ਅਧਿਆਪਕ ਕਲਾਸ ਵਿੱਚ ਆਉਂਦਾ ਹੈ ਆਪਣਾ ਇੱਕ ਘੰਟਾ ਪੂਰਾ ਕਰਦਾ ਹੈ ਪਰ ਕਲਾਸਾਂ ਪੂਰੀਆਂ ਨਹੀਂ ਲਾਉਂਦਾ ਕੁਛ ਪੜ੍ਹਾ ਕੇ ਨਹੀਂ ਜਾਂਦਾ ਪਰ ਉਹ ਆਪਣਾ ਸਮਾਂ ਖਰਾਬ ਕਰ ਰਿਹਾ ਹੈ ਇਹ ਵੀ ਇੱਕ ਭ੍ਰਿਸ਼ਟਾਚਾਰ ਦਾ ਰੂਪ ਹੈ ਭਾਰਤ ਵਿੱਚ ਬਹੁਤ ਸਾਰੇ ਅਜਿਹੇ ਸੰਵੇਦਨਸ਼ੀਲ ਵਿਸ਼ੇ ਹਨ ਜਿਨ ਜੋ ਭਾਰਤ ਵਿੱਚ ਵਰਜਿਤ ਹਨ ਨਸ਼ਾ ਭ੍ਰਿਸ਼ਟਾਚਾਰ ਪਰ ਇਹਨਾਂ ਉੱਪਰ ਕੋਈ ਰੋਕ ਨਹੀਂ ਲਗਾਈ ਜਾ ਰਹੀ ਇਹ ਦਿਨੋਂ ਦਿਨ ਵੱਧਦੇ ਜਾ ਰਹੇ ਹਨ ਅਤੇ ਭਾਰਤ ਦੇ ਭਵਿੱਖ ਨੂੰ ਖਤਰੇ ਵਿੱਚ ਪਾ ਰਹੇ ਹਨ